ਜਿਵੇਂ ਹੁਣ ਖਪਤਕਾਰ ਟਿਕਾਊ ਤੇ ਨੈਤਿਕ ਪੋਲਟਰੀ ਹੈ ਹਨਾ ਇਹਦਾ ਮਤਲਬ ਕਿ ਜਿਵੇਂ ਹੁਣ ਕਈ ਜਿਵੇਂ ਹੁਣੇ ਕੋਈ ਮਤਲਬ ਛੋਟਾ ਮੋਟਾ ਬਿਜਨਸ ਕਰਦੇ ਆ ਹਨਾ ਕਿਸਾਨ ਜਾਂ ਕੋਈ ਵੀ ਪਰਸਨ ਕਰਦਾ ਹਨਾ ਜਿਵੇਂ ਕੋਈ ਪੋਲਟਰੀ ਫਾਰਮ ਆਪਦਾ ਹੈਨਾ ਚਲਾਉਂਦਾ ਉਹਦੇ ਲਈ ਕੀ ਸਭ ਤੋਂ ਪਹਿਲਾਂ ਉਹਦੀ ਡਿਮਾਂਡ ਕੀ ਹੁੰਦੀ ਕਿ ਉਹਦੇ ਕੋਲ ਪਹਿਲਾਂ ਜਮੀਨ ਹੋਵੇ ਹਨਾ ਜਗ੍ਹਾ ਫਿਰ ਹੀ ਉਥੇ ਪੋਲਟਰੀ ਫਾਰਮ ਆਪਣਾ ਹਨਾ ਮਤਲਬ ਚਲਾਊਗਾ ਤੇ ਜਗ੍ਹਾ ਫਿਰ ਉਸ ਤੋਂ ਬਾਅਦ ਕਿ ਉਹਦੇ ਕੋਲ ਸਾਰਾ ਸੋਰਸ ਹੋਣੇ ਚਾਹੀਦੇ ਫਿਰ ਮੇਨ ਗੱਲ ਕਿਉਂਕਿ ਕੋਲ ਪੈਸਾ ਹੋਣਾ ਚਾਹੀਦਾ ਹਨਾ ਤੇ ਪੈਸਾ ਕੀ ਹੈ ਕਿ ਮਤਲਬ ਆਪਣੇ ਕੋਲ ਆਪਾਂ ਕੁਝ ਕੁ ਤਾਂ ਅਰੇਂਜ ਕਰ ਵੀ ਸਕਦੇ ਆਂ ਹਨਾ ਲੋਨ ਵਗੈਰਾ ਜੋ ਵੀ ਕਰਦੇ ਆ ਜਿਵੇਂ ਵੀ ਕਰਦੇ ਆ ਹਨਾ ਪਰ ਕਿ ਇਹਦੇ ਲਈ ਕਿਉਂਕਿ ਸਰਕਾਰ ਨੇ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਹੋਈਆਂ ਜਿਵੇਂ ਹੁਣ ਨਿਰਭਰ ਭਾਰਤ ਆਤਮ ਨਿਰਭਰ ਭਾਰਤ ਹੈਨਾ ਮਤਲਬ ਚੱਲ ਰਹੀ ਹੈ ਇਹਦੇ ਨਾਲ ਕਿਹਾ ਕਿ ਇਹਦੇ ਵਿੱਚ ਕੀ ਕਿ ਆਪਣੇ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਸਰਕਾਰ ਮਤਲਬ ਕਿ ਹਨਾ ਆਪਣੇ ਤੇ ਇਹਦੇ ਚ ਕੀ ਹੈ ਕਿ ਆਪਾਂ ਨੂੰ ਕੁਝ ਐਵੇਂ ਦੀਆਂ ਯੋਜਨਾਵਾਂ ਨਵੀਆਂ ਤਿਆਰ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ ਜਿਹਦੇ ਵਿੱਚ ਕੀ ਹੈ ਕਿ ਮਤਲਬ ਕਿ ਛੋਟੇ ਜਿਹੇ ਛੋਟੇ ਛੋਟੇ ਜਿਵੇਂ ਬਿਜ਼ਨਸ ਮੈਨ ਤੋਂ ਛੋਟੇ ਛੋਟੇ ਕਾਰੀਗਰ ਆ ਨਾ ਉਹਨਾਂ ਨੂੰ ਲੋਨ ਦਿੱਤਾ ਜਾਂਦਾ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਉਹਦੇ ਜਿਹੜਾ ਵਿਆਜ ਵੀ ਘੱਟ ਹੁੰਦਾ ਤੇ ਉਹ ਤੇ ਉਹ ਮਤਲਬ ਸਰਕਾਰ ਨੂੰ ਹੌਲੀ ਹੌਲੀ ਆਪਦਾ ਜਿਹੜਾ ਉਹਨੇ ਕਰਜਾ ਲਿਆ ਹੁੰਦਾ ਉਹ ਹੌਲੀ ਹੌਲੀ ਕਿਆ ਕਰਦਾ ਉਤਾਰ ਸਕਦਾ ਹਨਾ ਇਹ ਚ ਮੇਰੇ ਹਿਸਾਬ ਨਾਲ ਇਹ ਸਕੀਮ ਬਹੁਤ ਵਧੀਆ ਹਨਾ ਸਰਕਾਰੀ ਬਹੁਤ ਵਧੀਆ ਚਲਾਈਏ ਪਰ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਪਰ ਕਈ ਵਾਰੀ ਕੀ ਹੁੰਦਾ ਕੋਈ ਕੋਈ ਪਰਸਨ ਚਾਹੁੰਦਾ ਹੁੰਦਾ ਵੀ ਮੈਂ ਆਪਦਾ ਬਿਜ਼ਨਸ ਸ਼ੁਰੂ ਕਰਨਾ ਹਨਾ ਤੇ ਉਹਦੇ ਕੋਲੇ ਮਤਲਬ ਕਿ ਜਮੀਨ ਵੀ ਨਹੀਂ ਹੁੰਦੀ ਪੈਸਾ ਵੀ ਹੁੰਦਾ ਕੁਛ ਵੀ ਨਹੀਂ ਹੁੰਦਾ ਹਨਾ ਤੇ ਉਹਦੇ ਸਰਕਾਰ ਨੂੰ ਉਹਦੀ ਵੀ ਮਤਲਬ ਕਿ ਮਦਦ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਹਨਾ ਕਿਉਂਕਿ ਕਿਉਂਕਿ ਉਹ ਵਿਚਾਰੇ ਕਿਸੇ ਦਾ ਸੁਪਨਾ ਹੁੰਦਾ ਹਨਾ ਮੈਂ ਵੀ ਆਹ ਕੰਮ ਕਰਨਾ ਸੀ ਪਰ ਸਿਰਫ ਔਰ ਸਿਰਫ ਨਾ ਮਤਲਬ ਗਰੀਬੀ ਹੁੰਦੀ ਹੈ ਫਿਰ ਉਹਨੇ ਅਤੇ ਗਰੀਬੀ ਹੀ ਉਹਨੂੰ ਮਤਲਬ ਗਰੀਬੀ ਕਰਕੇ ਵਿਚਾਰੇ ਦਾ ਸੁਪਨਾ ਪੂਰਾ ਨਹੀਂ ਹੁੰਦਾ ਸੋ ਤੋ ਵੈਸੇ ਅੱਜ ਕੱਲ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਵਧੀਆ ਮਦਦ ਕਰ ਰਹੀ ਹੈ ਮੈਨੂੰ ਉਮੀਦ ਹੈ ਵੀ ਹਨਾ ਕਿ ਜੋ ਮੇਰੇ ਮਤਲਬ ਕਿ ਮੈਂ ਕਿਹਾ ਹਨਾ ਵੀ ਜਿਨਾਂ ਵਿਚਾਰੇ ਕੋਲ ਜਮੀਨ ਵੀ ਨਹੀਂ ਹੁੰਦੀ ਹਨਾ ਉਹਨਾਂ ਦੇ ਵੀ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਤੇ ਤੇ ਉਮੀਦ ਹੈ ਵੀ ਹਨਾ ਸੋਚਣ ਸਰਕਾਰ ਜਰੂਰ ਸੋਚੂਗੀ ਸੋ ਅੱਜ ਤੱਕ ਜਿਵੇਂ ਵੀ ਚੱਲਦਾ ਆ ਰਿਹਾ ਹਨਾ ਉਹਦੇ ਨਾਲੋਂ ਬਹੁਤ ਵਧੀਆ ਮਤਲਬ ਜਿਹੜੀਆਂ ਸਕੀਮ ਆਈ ਆ ਮੈਨੂੰ ਬਹੁਤ ਵਧੀਆ ਲੱਗੀ ਹਨਾ